ਜਿਹੜੇ ਸਾਡੇ ਇਲਾਕੇ ਦੇ ਜਿਹੜੇ ਹੈਗੇ ਆ ਸਕੂਲ ਹੈ ਉਹਨਾਂ ਵਿੱਚ ਇਤਿਹਾਸ ਪੜ੍ਹਾਇਆ ਜਾਂਦਾ ਹੈਗਾ ਏ ਉਹਨਾਂ ਵਿੱਚ ਪਹਿਲਾਂ ਤੋਂ ਹੀ ਇਤਿਹਾਸ ਪੜ੍ਹਾਇਆ ਜਾਂਦਾ ਹੈਗਾ ਏ ਇੱਕ ਸਾਡੀ ਸੋਸ਼ਲ ਸਟੱਡੀ ਦੀ ਬੁੱਕ ਹੁੰਦੀ ਹੈਗੀ ਏ ਉਹਦੇ ਵਿੱਚ ਅਲੱਗ ਤੋਂ ਇਤਿਹਾਸ ਨਾਂ ਦਾ ਇੱਕ ਚੈਪਟਰ ਮਤਲਬ ਉਹ ਹੁੰਦਾ ਹੈਗਾ ਏ ਪਾਰਟ ਹੁੰਦਾ ਹੈਗਾ ਏ ਉਹਦੇ ਵਿੱਚ ਇਤਿਹਾਸ ਪੜ੍ਹਾਇਆ ਜਾਂਦਾ ਹੈਗਾ ਏ ਬੜੇ ਵਧੀਆ ਢੰਗ ਨਾਲ ਪੜ੍ਹਾਇਆ ਜਾਂਦਾ ਹੈਗਾ ਏ ਕ੍ਰੀਏਟਿਵ ਢੰਗਾਂ ਨਾਲ ਟੀਚਰ ਵਧੀਆ ਆਪਦੇ ਢੰਗਾਂ ਨਾਲ ਪੜ੍ਹਾਉਂਦੇ ਹੈਗੇ ਆ ਉਹਨੂੰ ਇਤਿਹਾਸ ਨੂੰ ਅਤੇ ਇਹਦੇ ਵਿੱਚ ਥੋੜ੍ਹੀ ਬਹੁਤੀ ਚੇਂਜਿਸ ਕਰਕੇ ਥੋੜ੍ਹਾ ਡੀਪਲੀ ਬੱਚੇ ਨੂੰ ਪੜ੍ਹਾਏ ਜਾਣਾ ਚਾਹੀਦਾ ਤਾਂ ਜੋ ਜਿਹੜੀਆਂ ਸਾਡੀਆਂ ਮਤਲਬ ਆਲਾ ਦੁਆਲਾ ਕਿਆ ਕੁਝ ਵਾਪਰ ਰਿਹਾ ਹੈਗਾ ਜਾਂ ਪਹਿਲਾਂ ਕਿਆ ਕੁਝ ਹੋਇਆ ਸੀਗਾ ਉਹਨਾਂ ਨੇ ਕਿਸਤ ਕਿੱਦਾਂ ਸਿਰੀਆਂ ਨਾਲ ਨਜਿੱਠਿਆ ਅਤੇ ਅਸੀਂ ਜਿਹੜੀ ਸਾਨੂੰ ਪ੍ਰੋਬਲਮ ਫੇਸ ਆਉਂਦੀਆਂ ਹੈਗੀਆਂ ਆਪਾਂ ਉਹਨਾਂ ਨਾਲ ਕਿੱਦਾਂ ਨਜਿੱਠ ਸਕਦੇ ਹੈ